ਜਿਹੜੀ ਮੈਂ ਕਿਤਾਬ ਮੰਗਵਾਈ ਸੀ ਉਹ ਬਹੁਤ ਮੈਨੂੰ ਮਹਿੰਗੇ ਰੇਟ 'ਤੇ ਪਈ ਹਾਲਾਂਕਿ ਉਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਬਜ਼ਾਰ ਵਿੱਚ ਬੜੇ ਸਸਤੇ ਰੇਟਾਂ 'ਤੇ ਹੈ ਅਤੇ ਇਸ ਤੋਂ ਇਲਾਵਾ ਉਸ 'ਤੇ ਜਿਹੜੀ ਲਿਖਾਵਟ ਸੀਗੀ ਉਹ ਬਹੁ ਥੋੜ੍ਹੀ ਜਿਹੀ ਧੁੰਦਲੀ ਸੀਗੀ ਜੋ ਕਿ ਮੈਨੂੰ ਅਰਾਮ ਨਾਲ ਨਹੀਂ ਪੜ੍ਹੀ ਜਾ ਸਕਦੀ ਸੀ